ਭੰਗੜੇ ਦੇ ਕੁਛ ਆਮ ਸਟੈਪਸ ਹਨ ਜਿਵੇਂ ਕਿ ਝੂੰਮਰ ਧਮਾਲ ਚਾਲ ਅਤੇ ਲੁੱਡੀ ਹੋਰ ਸਟੈੱਪ ਜਿਵੇਂ ਕਿ ਸੰਮੀ ਸਿਆਲਕੋਟ ਖੁੰਡੇ ਅਤੇ ਮਿਰਜ਼ਾ ਇਹ ਕੁਝ ਭੰਗੜੇ ਦੇ ਆਮ ਸਟੈੱਪਾਂ ਵਿੱਚੋਂ ਆਉਂਦੇ ਹਨ ਭੰਗੜਾ ਇੱਕ ਨ੍ਰਿਤ ਹੈਗਾ ਹੈ ਜਿਹੜਾ ਕਿ ਪੰਜਾਬ ਵਿੱਚ ਕੀਤਾ ਜਾਂਦਾ ਹੈ ਨਾਲੇ ਇਹ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ਭੰਗੜੇ ਦਾ ਸਟੈੱਪ ਜਿਵੇਂ ਝੂੰਮਰ ਅਤੇ ਲੁੱਡੀ ਅਤੇ ਸਿਆਲਕੋਟ ਪੂਰੇ ਜ਼ੋਰਦਾਰ ਸਟੈੱਪ ਹੁੰਦੇ ਹਨ ਜਿਹੜੇ ਜਸ਼ਨ ਵਾਲੇ ਸੁਭਾਵ ਨੂੰ ਯੋਗਦਾਨ ਪਾਉਂਦੇ ਹਨ ਭੰਗੜਾ ਇੱਕ ਸੱਭਿਆਚਾਰੀ ਨ੍ਰਿਤ ਹੁੰਦਾ ਹੈ